ਹੈਲੋ ਹਾਂਜੀ ਭਾਅ ਜੀ ਮੈਂ ਨਾ ਇੱਕ ਫੋਨ ਖਰੀਦਣਾ ਸੀਗਾ ਤੁਸੀਂ ਮੈਨੂੰ ਦੱਸ ਸਕਦੇ ਤੁਹਾਡੇ ਲਵੇ ਕਿਹੜੇ ਕਿਹੜੇ ਫੋਨ ਅਵੇਲੇਬਲ ਨੇ ਵੀਰੇ ਮੈਨੂੰ ਤੁਸੀਂ ਦੱਸ ਦਿਓ ਆਈਫੋਨ ਅਤੇ ਐਂਡਰਾਇਡ ਦੋਨਾਂ ਬਾਰੇ ਦੱਸ ਦਿਓ ਲੱਖ ਰੁਪਏ ਤੱਕ ਦਾ ਹੈਗਾ ਬਜਟ ਜੀ ਹਾਂਜੀ ਠੀਕ ਹੈ ਜੀ ਹੋਰ ਕੁਛ ਐੱਸ ਟਵੈਂਟੀ ਫੌਰ ਟਵੈਂਟੀ ਫੌਰ ਨਹੀਂ ਭਾਅ ਜੀ ਨਹੀਂ ਨਹੀਂ ਜੀ ਇਨ ਇਹ ਤਾਂ ਜ਼ਿਆਦਾ ਕੋਸਟਲੀ ਹੋ ਜਾਊਗਾ ਠੀਕ ਹੈ ਜੀ ਠੀਕ ਹੈ ਅਤੇ ਐਪਲ ਦੀ ਕਿਹੜੀ ਕਿਹੜੀ ਰੇਂਜ ਮਿਲ ਜਾਊਗੀ ਆਪਾਂ ਨੂੰ ਚੌਦਾਂ ਜੀ ਚੌਦਾਂ ਪਰੋ ਮੈਕਸ ਜੀ ਕਿ ਚੌਦਾਂ ਇਕੱਲਾ ਕਿ ਚੌਦਾਂ ਪਲੱਸ ਜੀ

ਆਪਾਂ ਮ ਬਜਟ ਤਾਂ ਪਰੋ ਮੈਕਸ ਜਿਨ੍ਹਾਂ ਖਿੱਚ ਲਵਾਂਗੇ ਜੀ ਜੇ ਰੰਗ ਕਿਹੜੇ ਕਿਹੜੇ ਮਿਲ ਜਾਣਗੇ ਅੱਛਾ ਅੱਛਾ ਅਤੇ ਮੇਰੇ ਲਈ ਐਂ ਕਰਿਓ ਤੁਸੀਂ ਇੱਕ ਤਾਂ ਜੀ ਬੀ ਕਿੰਨੇ ਵਾਲਾ ਦਿਉਂਗੇ ਮੈਨੂੰ ਐਪਲ ਦਾ ਅਤੇ ਸੈਮਸੰਗ ਦਾ ਚੌਦਾਂ ਪਰੋ ਮੈਕਸ ਦੇਖ ਲਵਾਂਗੇ ਆਪਾਂ ਜਾਂ ਇੱਕ ਤੀਹ ਦਾ ਚਲੋ ਕੋਈ ਗੱਲ ਨਹੀਂ ਬਾਕੀ ਕਿਸ਼ਤਾਂ ਕਰਾ ਲਵਾਂਗੇ ਅੱਛਾ ਜੀ ਅੱਛਾ ਜੀ ਉਹ ਤਾਂ ਕੋਈ ਗੱਲ ਨਹੀਂ ਕਿਸ਼ਤਾਂ ਕਰਾ ਲਵਾਂਗੇ ਕੋਈ ਗੱਲ ਨਹੀਂ ਜੀ ਦੇਖ ਲੈਂਦੇ ਹਾਂ ਅਤੇ ਮੈਨੂੰ ਤੁਸੀਂ ਐਂ ਕਰੋ ਇੱਕ ਤਾਂ ਬਾਈ ਅਲਟਰਾ ਮੰਗਵਾ ਦਿਓ ਤੁਸੀਂ ਜਿਹੜਾ ਉਹਦਾ ਯੂਨੀਕ ਕਲਰ ਆ ਉਹ ਅਤੇ ਇੱਕ ਫੋਰਟੀਨ ਪਰੋ ਮੈਕਸ ਦਾ ਮੰਗਵਾ ਦਿਓ ਮੈਨੂੰ ਤੁਸੀਂ ਡੀਪ ਪਰਪਲ ਅਤੇ ਮੈਂ ਅਗਰ ਤੁਸੀਂ ਕਹੋ ਤਾਂ ਮੈਂ ਤੁਹਾਨੂੰ ਐਡਵਾਂਸ ਪਾ ਦਿੰਦਾ ਥੋੜ੍ਹਾ ਜਿਹਾ ਚਲੋ ਠੀਕ ਹੈ ਜੀ ਮੈਂ ਤੁਹਾਨੂੰ ਐਡਵਾਂਸ ਅਤੇ ਮੈਂ ਠੀਕ ਹੈ ਜੀ ਮੈਂ ਫਿਰ ਆਪਣਾ ਐਡਰੈੱਸ ਭੇਜ ਦੇਵਾਂਗਾ ਜੀ ਵੱਟਸਐਪ 'ਤੇ ਓਕੇ